ਕਿਸਾਨਾਂ ਦਾ ਮੁੱਖ ਧੰਦਾ ਮੁੱਖ ਕਿੱਤਾ ਜਿਹੜਾ ਵਾ ਉਹ ਖੇਤੀਬਾੜੀ ਹੈ ਕਿਸਾਨ ਖੇਤੀਬਾੜੀ ਨਾਲ ਜੁੜੇ ਹੋਏ ਹਨ ਪਰ ਹੁਣ ਮਹਿੰਗਾਈ ਹੋਣ ਦੇ ਕਾਰਨ ਕਿਸਾਨ ਆਪਣੀ ਖੇਤੀਬਾੜੀ ਤੋਂ ਗੁਜ਼ਾਰਾ ਨਹੀਂ ਕਰ ਪਾ ਰਹੇ ਇਸ ਲਈ ਉਹ ਖੇਤੀਬਾੜੀ ਤੋਂ ਇਲਾਵਾ ਹੋਰ ਧੰਦਿਆਂ ਨੂੰ ਵੀ ਆਪਣਾ ਰਹੇ ਹਨ ਜਿਵੇਂ ਮੱਛੀ ਪਾਲਣਾ ਮੁਰਗੀ ਪਾਲਣਾ ਸੂਰਾਂ ਦਾ ਫਾਰਮ ਡਾਇਰੀ ਫਾਰਮ ਲੱਕੜੀਆਂ ਉਗਾ ਦਰੱਖਤ ਉਗਾ ਕੇ ਉਹਨਾਂ ਨੂੰ ਵੇਚ ਕੇ ਪੈਸੇ ਕਮਾਉਣਾ ਆਦਿ ਜਿਹੜੇ ਧੰਦੇ ਆ ਉਹ ਕਿੱਤੇ ਆ ਕਿਸਾਨ ਅਪਣਾ ਰਹੇ ਹਨ ਇਸ ਦਾ ਮੁੱਖ ਕਾਰਨ ਇਹ ਹੀ ਹੈ ਕੇ ਕਿਸਾਨ ਕਿਸਾਨ ਖੇਤੀਬਾੜੀ ਨਾਲ ਰਿਲੇਟਡ ਹੋਣ ਕਰਕੇ ਸੰਬੰਧਿਤ ਹੋਣ ਕਰਕੇ ਉਹ ਆਪਣਾ ਗੁਜ਼ਾਰਾ ਮਹਿੰਗਾਈ ਹੋਣ ਕਰਕੇ ਆਪਣਾ ਗੁਜ਼ਾਰਾ ਨਹੀਂ ਕਰ ਸਕਦੇ ਇਸ ਲਈ ਉਹ ਖੇਤੀਬਾੜੀ ਤੋਂ ਇਲਾਵਾ ਇਹਨਾਂ ਧੰਦਿਆਂ ਨੂੰ ਅਪਣਾ ਕੇ ਆਪਣੇ ਜੀ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ਕਰ ਰਹੇ ਹਨ ਤਾਂ ਕਿ ਉਹਨਾਂ ਦਾ ਜਿਹੜਾ ਗੁਜ਼ਾਰਾ ਹੈ ਜੀਵਨ ਹੈ ਉਹ ਚੰਗੇ ਤਰੀਕੇ ਨਾਲ ਨਿਕਲ ਸਕੇ ਉਹਨਾਂ ਦੇ ਪਰਿਵਾਰ ਦੀ ਪਰਵਰਿਸ਼ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਹੋ ਸਕੇ